ਮੈਂ ਜ਼ਿੰਦਗੀ 'ਚ ਸਭ ਤੋਂ ਵੱਧ ਕਦਰ ਜ਼ਿੰਦਗੀ ਦੀ ਹੀ ਕਰਦੀ ਹਾਂ ਕਿਉਂਕਿ ਜੇ ਜ਼ਿੰਦਗੀ ਨਾ ਹੁੰਦੀ ਤਾਂ ਸਾਡੀ ਹੋਂਦ ਨਹੀਂ ਹੋਣੀ ਸੀ ਸਾਡੀ ਹੋਂਦ ਹੈ ਤਾਂ ਸਾਨੂੰ ਕੰਮ ਕਰਨ ਲਈ ਆਪੋਰਚੁਨਿਟੀਜ਼ ਮਿਲ ਰਹੀਆਂ ਆਂ ਜ਼ਿੰਦਗੀ ਦੇ ਵਿੱਚ ਵੀ ਇਨਸਾਨੀ ਜ਼ਿੰਦਗੀ ਕਿਉਂਕਿ ਜੀ ਤਾਂ ਜਾਨਵਰ ਪੰਛੀ ਵੀ ਰਹੇ ਆ ਮਗਰ ਜਿਹੜਾ ਇਨਸਾਨ ਹੈ ਉਹ ਆਪਣੀ ਮਰਜ਼ੀ ਨਾਲ ਆਪਣੇ ਟਾਈਮ ਨੂੰ ਮੋੜ ਸਕਦਾ ਆ ਇਹ ਔਖਾ ਤਾਂ ਹੈ ਮਗਰ ਨਾ ਮੁਮਕਿਨ ਨਹੀਂ ਹੈ ਕਿਉਂਕਿ ਇੱਕ ਅੱਖਰ ਹੁੰਦਾ ਇਮਪੋਸੀਬਲ ਉਹਦੇ ਵਿੱਚੋਂ ਜੇ ਇਮ ਹਟਾ ਦਈਏ ਤਾਂ ਪੋਸੀਬਲ ਬਚਦਾ ਹੈ ਗੱਲ ਇਹ ਹੈ ਕਿ ਅਸੀਂ ਭਰੇ ਹੋਏ ਗਿਲਾਸ ਨੂੰ ਕਿਵੇਂ ਦੇਖ ਰਹੇ ਹਾਂ ਅੱਧਾ ਖਾਲੀ ਕਿ ਅੱਧਾ ਭਰਿਆ ਤੁਹਾਡੇ 'ਤੇ ਡਿਪੈਂਡ ਕਰਦਾ ਹੈ ਇਸ ਤਰ੍ਹਾਂ ਮੁਸੀਬਤਾਂ ਤਾਂ ਜ਼ਰੂਰ ਆਉਂਦੀਆਂ ਚਾਹੇ ਰਾਜਾ ਆ ਅਤੇ ਚਾਹੇ ਰੰਕ ਹੈ ਮੁਸੀਬਤ ਹਰੇਕ ਨੂੰ ਆਉਂਦੀ ਆ ਹਰੇਕ ਕੋਲ ਆਪਣੇ ਆਪਣੇ ਦੁੱਖ ਨੇ ਮਗਰ ਉਹਨਾਂ ਦੁੱਖਾਂ ਨਾਲ ਅਸੀਂ ਡੀਲ ਕਿਵੇਂ ਕਰਦੇ ਹਾਂ ਇਹੀ ਜ਼ਿੰਦਗੀ ਹੈ ਅਸੀਂ ਰੱਬ ਦਾ ਨਾਂ ਵੀ ਲੈ ਸਕਦੇ ਹਾਂ ਅਸੀਂ ਆਪਣੇ ਕੰਮ ਵੀ ਕਰ ਸਕਦੇ ਹਾਂ ਪੈਸਾ ਥੋੜ੍ਹਾ ਆ ਜ਼ਿਆਦਾ ਆ ਮੈਟਰ ਇਹ ਨਹੀਂ ਕਰਦਾ ਮੈਟਰ ਤੁਹਾਡੀ ਖੁਸ਼ੀ ਕਰਦੀ ਆ ਰੋਣ ਵਾਲਾ ਜ਼ਿਆਦਿਆਂ 'ਚ ਵੀ ਰੋ ਲੈਂਦਾ ਆ ਤਾਂ ਖੁਸ਼ ਰਹਿਣ ਵਾਲਾ ਥੋੜ੍ਹਿਆਂ 'ਚ ਵੀ ਖੁਸ਼ ਰਹਿ ਲੈਂਦਾ ਆ ਹੈ ਨਾ ਹੁਣ ਕਹਾਣੀ ਤਾਂ ਇਹ ਹੈ ਵੀ ਅਸੀਂ ਓਨਾ ਕਰਨਾ ਕਿਵੇਂ ਆ ਬਾਕੀ ਸਭ ਕੁਝ ਸਾਡੇ ਹੱਥ ਆ